ਹੈਲੋ ਹਾਂਜੀ ਸਰ ਗੁਰਸੇਵਕ ਸਿੰਘ ਜੀ ਬੋਲ ਰਹੇ ਹੋ ਹਾਂਜੀ ਮੇਰਾ ਮਤਲਬ ਸਰ ਫਰਿੱਜ ਖਰਾਬ ਹੋ ਗਿਆ ਸੀ ਮੈਂ ਲਾਸਟ ਏਅਰ ਲਿਆ ਸੀਗਾ ਉਹ ਸੈਮਸੰਗ ਦਾ ਏ ਸਰ ਹਾਂਜੀ ਉਹ

ਠੀਕ ਐ ਠੀਕ ਐ ਹਾਂਜੀ ਸਰ ਉਹਦੇ ਨਾਲ ਮਤਲਬ ਕੂਲਿੰਗ ਨਹੀਂ ਕਰਦਾ ਉੱਪਰ ਵਾਲਾ ਫਰਿੱਜ਼ ਐ ਨਾ ਜਿਹੜਾ ਹਾਂਜੀ ਉਹ ਤੇ ਮਤਲਬ ਆਈਸ ਬਣਦੀ ਨਹੀਂ ਪੂਰੀ ਪ੍ਰੋਪਰ ਪਤਾ ਨਹੀਂ ਹੁਣ ਗੈਸ ਲੀਕ ਐ ਜਾਂ ਪਿੱਛੋਂ ਉਹ ਜਿਹੜੀ ਪਿੱਛੇ ਵਾਲੀ ਮੋਟਰ ਮੇਰੇ ਹਿਸਾਬ ਨਾਲ ਉਤੋਂ ਗੈਸ ਲੀਕ ਐ ਬਾਕੀ ਮੈਂ ਚੈੱਕ ਕਰਾਉਣਾ ਸੀਗਾ ਥੋਨੂੰ ਹਾਂਜੀ ਹਾਂਜੀ ਭੇਜ ਦੂਗਾ ਸਰ ਸਕਰੀਨ ਫੋਟੋ ਖਿਚ ਕੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਸਰ ਸਰ ਮੇਰਾ ਵੀਜ਼ਾ ਕਲੋਨੀ ਫਾਜ਼ਿਲਕਾ ਸਰ ਹਾਂਜੀ ਹਾਂਜੀ ਹਾਂਜੀ ਸਰ ਫਿਰ ਉਹਦੇ ਹਾਂਜੀ ਸਰ ਹਾਊਸ ਨੰਬਰ ਸਤੱਤਰ ਵੀਹ ਸਟਰੀਟ ਨੰਬਰ ਥਰੀ ਵਿਜੈ ਕਲੌਨੀ ਫਾਜ਼ਿਲਕਾ ਸਰ ਉਹਦੇ ਨਾਲ ਜਿਹੜਾ ਸਰ ਫਾਜ਼ਿਲਕਾ ਜੀ ਹਾਂਜੀ ਤਹਿਸੀਲ ਵੀ ਫਾਜ਼ਿਲਕਾ ਸਰ ਮੈਂ ਲੋਕਲ ਹੀ ਰਹਿਣਾ ਹਾਂਜੀ ਹਾਂਜੀ ਹਾਂਜੀ ਸਰ ਠੀਕ ਐ ਸਰ ਹਾਂਜੀ ਠੀਕ ਠੀਕ ਐ ਸਰ ਹਾਂਜੀ ਸਰ ਹਾਂਜੀ ਸਰ ਉਹ ਜਿਹੜੀ ਮੋਟਰ ਐ ਨਾ ਇਹਦੀ ਫਰਿਜ ਦੀ ਉਹਦੇ ਸਰ ਗੈਸ ਲੀਕਿੰਗ ਦੀ ਆਵਾਜ਼ ਵੀ ਆਉਂਦੀ ਸਰ ਪਤਾ ਨਹੀਂ ਉਹਦਾ ਟਾਂਕਾ ਉਖੜ ਗਿਆ ਜਾਂ ਕੁਝ ਹਾਂਜੀ ਹਾਂਜੀ ਨੋਆਈਸ ਵੀ ਕਰਦੀ ਥੋੜੀ ਥੋੜੀ ਹਾਂਜੀ ਸਰ ਹਾਂਜੀ ਠੀਕ ਐ ਸਰ ਹਾਂਜੀ ਹਾਂਜੀ ਵਾਰੰਟੀ ਐ ਵੈਸੇ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਸਰ ਲਾਸਟ ਏਅਰ ਲਿਆ ਸੀ ਹਾਂਜੀ ਸਰ ਹਾਂਜੀ ਸਰ ਸਰ ਇਹ ਕਿੰਨੇ ਕ ਟਾਈਮ ਤੱਕ ਮਤਲਬ ਮਕੈਨਿਕ ਪ੍ਰੋਵਾਈਡ ਹੋ ਜਾਣਾ ਆਪਣੇ ਕੋਲ ਕਦੋਂ ਕ ਤੱਕ ਪਹੁੰਚ ਜਾਏਗਾ ਅੱਛਾ ਸਰ ਹਾਂਜੀ ਹਾਂਜੀ ਸਰ ਥੋੜਾ ਅਰਜੈਂਟ ਸੀਗਾ ਨਾ ਤਾਂ ਹੀ ਪੁੱਛ ਰਹੇ ਸੀ ਠੀਕ ਐ ਸਰ ਇਹਦੀ ਮਤਲਬ ਇਹੀ ਰਿਕੁਾਇਰਮੈਂਟ ਸੀ ਕੋਈ ਹੋਰ ਤਾਂ ਨਹੀਂ ਸਰ ਠੀਕ ਐ ਸਰ ਜਿੰਨਾ ਹੋ ਸਕੇ ਤੁਸੀਂ ਜਲਦੀ ਕਰਾ ਦੇਣਾ ਸਰ ਹਾਂਜੀ ਠੀਕ ਐ ਥੈਂਕ ਯੂ ਸਰ ਠੀਕ